ਪੰਜਾਬ ਵਿੱਚ ਸ ਸਿਹਤ ਸੰਭਾਲ ਕਰਮਚਾਰੀ ਅਲੱਗ ਅਲੱਗ ਜਗ੍ਹਾ ਤੋਂ ਸਿਖਲਾਈ ਪ੍ਰਾਪਤ ਕਰਦੇ ਆ ਕੁਛ ਪ੍ਰਾਈਵੇਟ ਹੋਸਪਿਟਲਸ ਤੋਂ ਕਰਦੇ ਆ ਕੋਈ ਮੈਡੀਕਲ ਕੋਲਜਿਸ ਤੋਂ ਕਰਦੇ ਆ ਕੋਈ ਡਾਕਟਰਸ ਦੇ ਨੀਚੇ ਮਤਲਬ ਐਜ ਏ ਹੈਲਪਰ ਕੰਮ ਕਰਦੇ ਨੇ ਫਿਰ ਹੋਰ ਵੀ ਕਾਫ਼ੀ ਜਗ੍ਹਾ ਤੋਂ ਸਿਖਲਾਈ ਪ੍ਰਾਪਤ ਕਰ ਸਕਦੇ ਹਾਂ ਮੈਡੀਕਲ ਕੋਰਸਿਸ ਵਗੈਰਾ ਤੋਂ ਫਿਰ ਜਿੱਦਾਂ ਉਹ ਸਿਖਲਾਈ ਪ੍ਰਾਪਤ ਕਰਦੇ ਆ ਉਸ ਤੋਂ ਬਾਅਦ ਉਹ ਸਮਾਜ ਲਈ ਸ ਮਤਲਬ ਓਹ ਮੈਡੀਕਲ ਫੀਲਡ ਵਿੱਚ ਸਮਰਥਨ ਵੀ ਦਿੰਦੇ ਆ ਆਪਣਾ ਅਗਰ ਕਿਸੇ ਨੂੰ ਨਰਸਿੰਗ ਕੋਰਸ ਕੀਤਾ ਫਿਰ ਉਹ ਨਰਸ ਬਣਦੀ ਆ ਆਪਣੇ ਨਰਸਿੰਗ ਡਿਊਟੀਸ ਪੂਰੀਆਂ ਕਰਦੀ ਆ ਉੱਦਾਂ ਕਰਕੇ ਉਹ ਸਮਰਥਨ ਦਿੰਦੇ ਆ ਫਿਰ ਅਗਰ ਕਿਸੇ ਨੇ ਕੋਈ ਮਤਲਬ ਐੱਮ ਬੀ ਬੀ ਐੱਸ ਦਾ ਕੋਰਸ ਕੰਪਲੀਟ ਕਰ ਲਿਆ ਹੋਇਆ ਵਾ ਫਿਰ ਉਹ ਹੋਸਪਿਟਲਜ਼ ਦੇ ਵਿੱਚ ਜਦੋਂ ਇੰਟਰਨਸ ਬਣਦੇ ਆ ਮਤਲਬ ਕਿ ਉਹਨਾਂ ਦੀ ਪ੍ਰੋਪਰ ਜਦੋਂ ਤੱਕ ਉਹਨਾਂ ਨੂੰ ਇੱਕ ਜੋਬ ਨਹੀਂ ਮਿਲ ਜਾਂਦੀ ਉਹ ਵੀ ਸਮਰਥਨ ਦਿੰਦੇ ਇੱਦਾਂ ਅਲੱਗ ਅਲੱਗ ਸਿਖਲਾਈ 'ਤੇ ਅਲੱਗ ਅਲੱਗ ਸਮਰਥਨ ਦਿੰਦੇ ਆ ਪੰਜਾਬ ਪੰਜਾਬ ਦੇ ਵਿੱਚ ਸਿਹਤ ਸੰਭਾਲ ਕਰਮਚਾਰੀ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਮਤਲਬ ਸਿਹਤ ਸੰਭਾਲ ਦੇ ਪੇਸ਼ੇ ਵਿੱਚ ਕਾਫ਼ੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਾਫ਼ੀ ਜ਼ਿਆਦਾ ਮਤਲਬ ਜਿੱਦਾਂ ਇਹ ਪੜ੍ਹਾਈ ਆ ਕਾਫ਼ੀ ਔਖੀ ਆ ਪੰਜਾਬ ਦੇ ਮਤਲਬ ਜ਼ਿਆਦਾਤਰ ਇਹ ਨਹੀਂ ਆ ਕਿ ਹ ਕਾਲਜ ਦੇ ਵਿੱਚ ਅਵੇਲੇਬਲ ਹੋਵੇ ਹੀ ਹੋਵੇ ਮਤਲਬ ਕਾਫ਼ੀ ਜਿੱਦਾਂ ਪੰਜਾਬ ਅਤੇ ਅਗਰ ਦਿੱਲੀ ਦੇ ਵਿੱਚ ਫ਼ਰਕ ਦੇਖਿਆ ਜਾਵੇ ਤਾਂ ਕਾਫ਼ੀ ਜ਼ਿਆਦਾ ਵਾ ਕਿ ਜੋ ਜਿੱਦਾਂ ਡੋਕਟਰਸ ਆ ਉਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਆ ਜਦੋਂ ਦਿੱਲੀ ਵਿੱਚ ਹਾਂ ਇਹ ਵੀ ਆ ਕਿ ਪੰਜਾਬ ਵਿੱਚ ਵੀ ਹੈਗੇ ਆ ਬਟ ਹਾਂ ਇੱਦਾਂ ਕਰਕੇ ਫਿਰ ਕਈ ਹੋਸਪਿਟਲਜ਼ ਆ ਜਿੱਦਾਂ ਉੱਥੇ ਪ੍ਰੋਪਰ ਇਕੋਪਮੈਂਟਸ ਨਹੀਂ ਅਵੇਲੇਬਲ ਇੱਦਾਂ ਕਰਕੇ ਕਈ ਮੈਡੀਕਲ ਕੋਲਜਿਸ 'ਚ ਵੀ ਜਿੱਦਾਂ ਜੋ ਚੀਜ਼ ਚਾਹੀਦੀ ਆ ਇੱਕ ਪੜ੍ਹਾਉਣ ਲਈ ਅਗਰ ਜਿੱਦਾਂ ਕਿ ਹੁਣ ਕੋਈ ਡੈਡ ਬੋਡੀ ਹੁੰਦੀ ਆ ਆਪਾਂ ਉਹਦੇ ਪਾਰਟਸ ਦਿਖਾਉਂਦੇ ਹਾਂ ਆਪਣੇ ਸਟੂਡੈਂਟਸ ਨੂੰ ਦੱਸਦੇ ਹਾਂ ਫਿਰ ਸਟਿੱਚ ਕਿੱਦਾਂ ਕਰਨਾ ਇਹ ਸਭ ਕੁਝ ਕਈ ਮੈਡੀਕਲ ਕੋਲਜਿਸ ਵਿੱਚ ਇਹੋ ਜਿਹੀਆਂ ਫੈਸਿਲਿਟੀਜ਼ ਨਹੀਂ ਅਵੇਲੇਬਲ ਹੁੰਦੀਆਂ ਹੋਰ ਵੀ ਕਾਫ਼ੀ ਚੀਜ਼ਾਂ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ